ਪੰਜਾਬ ਦੇ ਹਿੱਸੇ ਬਹੁਤ ਅਮੀਰ ਵਿਰਾਸਤ ਹੈ ਜਿਸ ਵਿੱਚ ਫੁਲਕਾਰੀ ਕੱਢਣਾ ਸ਼ਿਲਪਕਾਰੀ ਕਲਾ ਦੇ ਵਰਗੇ ਹੱਥ ਰੱਸੀ ਹੁਨਰ ਹਨ ਜਿਹਨਾਂ ਨੂੰ ਆਪਣੀ ਵਿਰਾਸਤ ਨਾਲ ਪਿਆਰ ਹੁੰਦਾ ਹੈ ਉਹ ਸ਼ੁਰੂ ਤੋਂ ਹੀ ਉਸ ਵੱਲ ਖਿੱਚ ਮਹਿਸੂਸ ਕਰਦੇ ਹਨ ਅੱਜ ਕੱਲ੍ਹ ਦੇ ਨਵੇਂ ਡਿਜ਼ਾਇਨਾਂ ਵਿੱਚ ਵੀ ਪੁਰਾਣੇ ਵਿਰਸੇ ਦੀਆਂ ਝਲਕੀਆਂ ਆਪ ਨੂੰ ਆਪਾਂ ਨੂੰ ਅਕਸਰ ਨਜ਼ਰ ਆਉਂਦੀਆਂ ਹਨ ਅਤੇ ਇਸ ਕਰਕੇ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਅਤੇ ਉਤਸਾਹਿਤ ਕਰਨ ਵਿੱਚ ਕਲਾ ਅਤੇ ਸ਼ਿਲਪਕਾਰੀ ਦੀ ਭੂਮਿਕਾ ਹੈ